ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਕੀ ਸਰ ਕੀ ਮੇਰੀ ਗੱਲ ਗੋਰਵ ਫਾਰਮੈਸੀ ਦੇ ਵਿੱਚ ਹੋ ਰਹੀ ਹੈ ਹਾਂਜੀ ਸਰ ਹਾਂਜੀ ਸਰ ਐਕਚੂਅਲੀ ਮੈਂ ਇਹ ਪੁੱਛਣਾ ਸੀ ਕਿ ਹੁਣ ਨਾ ਮੇਰੇ ਹਾਫ਼ ਸਿਰ ਦੇ ਵਿੱਚ ਹੈੱਡਏਕ ਬਹੁਤ ਜ਼ਿਆਦਾ ਹੁੰਦੀ ਹੈ ਪਹਿਲਾਂ ਇੱਦਾਂ ਦੀ ਮਤਲਬ ਕੋਈ ਪ੍ਰੋਬਲਮ ਨਹੀਂ ਸੀ ਪਰ ਹੁਣ ਬਹੁਤ ਜ਼ਿਆਦਾ ਹੋ ਰਹੀ ਹੈ ਅਤੇ ਮੇਰੀ ਫ਼ਰੈਂਡ ਨੇ ਮੈਨੂੰ ਤੁਹਾਡਾ ਕੋਨਟੈਕਟ ਨੰਬਰ ਦਿੱਤਾ ਸੀ ਅਤੇ ਕੀ ਤੁਸੀਂ ਮੈਨੂੰ ਕੋਈ ਵਧੀਆ ਮਤਲਬ ਇੱਦਾਂ ਮੈਡੀਸਨ ਬਾਰੇ ਦੱਸ ਸਕਦੇ ਹੋ ਜਾਂ ਹੋਸਪੀਟਲ ਡੋਕਟਰ ਬਾਰੇ ਕੁਛ ਸਲਾਹ ਦੇ ਸਕਦੇ ਹੋ ਹਾਂਜੀ ਸਰ ਮੋਹਾਲੀ ਲੌਕਲ ਹਾਂ ਹਾਂਜੀ ਸਰ ਠੀਕ ਹੈ ਸਰ ਕੀ ਮੈਨੂੰ ਇਹਨਾਂ ਦਾ ਕੋਨਟੈਕਟ ਨੰਬਰ ਮਿਲ ਸਕਦਾ ਹੈ ਅਤੇ ਠੀਕ ਹੈ ਸਰ ਤੁਸੀਂ ਮੈਨੂੰ ਭੇਜ ਦਿਉ ਅਤੇ ਮੈਂ ਆਪਣੇ ਆਪ ਕੋਨਟੈਕਟ ਕਰ ਲਵਾਂਗੀ ਅਤੇ ਥੈਂਕ ਯੂ ਸਰ